ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿਵੇਂ ਸ਼ਲੋਕ ਹੈ ਰੁੱਖੀ ਮਿਸੀ ਖਾਇ ਕੈ ਠੰਡਾ ਪਾਣੀ ਪੀਓ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ ਇਸ ਦਾ ਮਤਲਬ ਇਹ ਹੈ ਕਿ ਸਾਨੂੰ ਕਿਸੇ ਦੂਜੇ ਦੀ ਵੱਲ ਦੇਖ ਕੇ ਆਪਣਾ ਮਨ ਨਹੀਂ ਦੁਖੀ ਕਰਨਾ ਚਾਹੀਦਾ ਉਸ ਜੋ ਸਾਡੇ ਪਾਸ ਹੈ ਉਸੇ ਵਿੱਚ ਹੀ ਸਬਰ ਕਰਨਾ ਚਾਹੀਦਾ ਹੈ ਕਿਸੇ ਹੋਰ ਵੱਲ ਦੇਖ ਕੇ ਦੁਖੀ ਨਹੀਂ ਹੋਣਾ ਚਾਹੀਦਾ ਅਤੇ ਜੋ ਹੈ ਉਸੇ 'ਚ ਸਬਰ ਕਰਨਾ ਚਾਹੀਦਾ ਹੈ